ਪੰਜਾਬ ਦਾ ਸੱਭਿਆਚਾਰਕ ਬਹੁਤ ਬਦਲ ਗਿਆ ਬੱਚੇ ਸਭ ਬਾਹਰ ਜਾ ਰਹੇ ਨੇ ਜਿਨ੍ਹਾਂ ਨੇ ਜਾ ਕੇ ਬਾਹਰਲਾ ਪਹਿਰਾਵਾ ਵੀ ਅਪਣਾ ਲਿਆ ਇੱਥੇ ਦੀ ਮਾਂ ਬੋਲੀ ਪੰਜਾਬ ਦੀ ਬਿਲਕੁਲ ਭੁੱਲ ਗਏ ਨੇ ਪੱਛਮੀ ਸੱਭਿਆਚਾਰਕ ਦੇ ਵਿੱਚ ਚਲੇ ਗਏ ਉਹ ਉਹ ਗਲਤ ਹੋ ਗਿਆ ਅਤੇ ਬੱਚੇ ਇੱਧਰ ਦੇ ਕਲਚਰ ਨੂੰ ਭੁੱਲ ਗਏ ਪੰਜਾਬ ਦੇ ਨੂੰ